ਰਾਜ ਸਰਕਾਰ ਕਾਨੂੰਨੀ ਵਿਵਾਦਾਂ ਨੂੰ ਅਲੱਗ ਅਲੱਗ ਤਰੀਕਿਆਂ ਨਾਲ ਹੱਲ ਕਰਦੀ ਹੈ ਜਿਵੇਂ ਕਿ ਅਸੀਂ ਕੋਈ ਵੀ ਆਪਣੀ ਮੁਸ਼ਕਿਲ ਨੂੰ ਵੈਬਸਾਈਟ 'ਤੇ ਭਰ ਕੇ ਉਸ ਦਾ ਹੱਲ ਕੱਢ ਸਕਦੇ ਹਾਂ ਜਿਵੇਂ ਕੋਈ ਆਪਣੇ ਨਾਲ ਸਾਈਬਰ ਕ੍ਰਾਈਮ ਹੋਇਆ ਹੈ ਜਾਂ ਹੋਰ ਤਰੀਕੇ ਦਾ ਕ੍ਰਾਈਮ ਉਸ ਤਰੀਕੇ ਦੀ ਕੋਈ ਵੀ ਮੁਸ਼ਕਿਲ ਆਈ ਹੈ ਤਾਂ ਉਸ ਤਰੀਕੇ ਨਾਲ ਹੱਲ ਕਰਦੇ ਹਾਂ ਲੋਕ ਅਦਾਲਤਾਂ ਹੁੰਦੀਆਂ ਹਨ ਜਿਸ ਵਿੱਚ ਅਸੀਂ ਆਪਣਾ ਪੱਖ ਰੱਖ ਸਕਦੇ ਹਾਂ ਉਸ ਤਰੀਕੇ ਨਾਲ ਵੀ ਰਾਜ ਸਰਕਾਰ ਹੱਲ ਕਰਦੀ ਹੈ ਜਾਂ ਆਪਣੇ ਕੋਲ ਹੋਰ ਬਹੁਤ ਸਾਰੇ ਤਰੀਕੇ ਹਨ ਜਿਹਨਾਂ ਵਿੱਚ ਰਾਜ ਸਰਕਾਰ ਆਪਣੀ ਮਦਦ ਕਰਦੀ ਹੈ ਅਤੇ ਅਸੀਂ ਆਪਣੀ ਸਮੱਸਿਆ ਦਾ ਹੱਲ ਲੱਭ ਸਕਦੇ ਹਾਂ ਅੱਜ ਕੱਲ੍ਹ ਕੋਈ ਵੀ ਅਜਿਹੀ ਮੁਸ਼ਕਿਲ ਨਹੀਂ ਹੈ ਜਿਸਦਾ ਹੱਲ ਨਾ ਹੋ ਸਕੇ ਕਿਉਂਕਿ ਬਹੁਤ ਸਾਰੇ ਤਰੀਕੇ ਅੱਜ ਕੱਲ੍ਹ ਆਪਾਂ ਨੂੰ ਇੰਟਰਨੈਟ 'ਤੇ ਮਿਲ ਜਾਂਦੇ ਹਨ ਅਲੱਗ ਅਲੱਗ ਵੈਬਸਾਈਟਸ ਬਣੀਆਂ ਹੋਈਆਂ ਹਨ ਜੇਕਰ ਤੁਹਾਨੂੰ ਕੋਈ ਤੁਹਾਡੀ ਕੋਈ ਗਲਤ ਫੋਟੋ ਨੈੱਟ 'ਤੇ ਪਾ ਦਿੰਦਾ ਹੈ ਤਾਂ ਉਸ ਲਈ ਵੀ ਅਲੱਗ ਤਰੀਕੇ ਦੇ ਅਲੱਗ ਅਲੱਗ ਤਰੀਕਿਆਂ ਦੀਆਂ ਵੈਬਸਾਈਟਸ ਬਣੀਆਂ ਹੋਈਆਂ ਹਨ ਕਿ ਅਸੀਂ ਉਸ ਤਰ ਉਸ ਬੰਦੇ ਨੂੰ ਕਿਵੇਂ ਫੜ ਸਕਦੇ ਹਾਂ ਜੇ ਤੁਹਾਡੇ ਨਾਲ ਕੋਈ ਠੱਗੀ ਮਾਰਦਾ ਹੈ ਕੋਈ ਫਰੋਡ ਕਰਦਾ ਹੈ ਤਾਂ ਉਸ ਤਰੀਕੇ ਦੀਆਂ ਵੀ ਬਹੁਤ ਸਾਰੀਆਂ ਵੈਬਸਾਈਟਸ ਬਣੀਆਂ ਹੋਈਆਂ ਹਨ ਜਿਹਨਾਂ ਨਾਲ ਚੋਰ ਬਹੁਤ ਜਲਦੀ ਹੀ ਫੜਿਆ ਜਾਂਦਾ ਹੈ